ਸਤਿ ਸ਼੍ਰੀ ਅਕਾਲ ਦੇਖੋ ਪਾਣੀ ਦੀ ਲੋੜ ਤਾਂ ਸਾਰਿਆਂ ਨੂੰ ਹੀ ਪੈਂਦੀ ਹੈ ਚਾਹੇ ਇਨਸਾਨ ਪਸ਼ੂ ਹੋਏ ਪਕਸ਼ੀ ਹੋਏ ਜਿਹਨੂੰ ਮਰਜੀ ਉਹ ਪਾਣੀ ਦੀ ਲੋੜ ਪੈਂਦੀ ਹੀ ਪੈਂਦੀ ਹੈ ਬਾਕੀ ਰਹੀ ਗੱਲ ਦਿਨ ਦੌਰਾਨ ਦੇ ਪਾਣੀ ਦੀ ਲੋੜ ਸਭ ਤੋਂ ਪਹਿਲਾਂ ਤਾਂ ਜੇ ਸਵੇਰੇ ਸਵੇਰੇ ਉੱਠੀਏ ਤਾਂ ਸਵੇਰੇ ਸਵੇਰੇ ਉੱਠਦੇ ਹੀ ਸਾਡਾ ਸਰੀਰ ਡੀਹਾਈਡਰੇਟ ਯਾਨੀ ਕਿ ਪਾਣੀ ਦੀ ਕਮੀ ਨਾਲ ਉੱਠਦਾ ਹੈ ਇਸ ਕਰਕੇ ਸਾਨੂੰ ਸਵੇਰੇ ਉੱਠਦੇ ਹੀ ਪਾਣੀ ਦੀ ਲੋੜ ਹੁੰਦੀ ਹੈ ਉਸ ਤੋਂ ਬਾਅਦ ਜੇ ਕੋਲਜ ਜਾਂਦੇ ਹਾਂ ਕਿਤੇ ਵੀ ਜਾਂਦੇ ਹਾਂ ਉਹਦੇ ਦੌਰਾਨ ਵੀ ਸਾਨੂੰ ਪਾਣੀ ਲੈਣਾ ਚਾਹੀਦਾ ਕਿਉਂਕਿ ਸਾਨੂੰ ਆਪਣੀ ਸਰੀਰ ਨੂੰ ਪਾਣੀ ਤੋਂ ਹਮੇਸ਼ਾ ਭਰਿਆ ਰੱਖਣਾ ਚਾਹੀਦਾ ਹੈ ਕਿਉਂਕਿ ਸਾਡਾ ਸੈਵਨਟੀ ਏਟ ਪਰਸੈਂਟ ਸਰੀਰ ਹੀ ਪਾਣੀ ਨਾਲ ਬਣਿਆ ਹੁੰਦਾ ਜੇ ਅਸੀਂ ਪਾਣੀ ਦੀ ਨਾ ਆਪਣੇ ਸਰੀਰ ਵਿੱਚ ਭਰਤੀ ਰੱਖਾਂਗੇ ਤਾਂ ਸਾਨੂੰ ਡੀਹਾਈਡ੍ਰੇਸ਼ਨ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਜਿਹਦੇ ਨਾਲ ਸਾਨੂੰ ਜਾਂ ਤਾਂ ਗਰਮੀ ਪੈ ਜੇਗੀ ਸਾਡੇ ਸਰੀਰ ਦੇ ਵਿੱਚ ਜਾਂ ਸਾਡੇ ਓਰਗਨ 'ਤੇ ਇਫੈਕਟ ਪੈ ਸਕਦਾ ਹੈ ਇੱਦਾਂ ਵੀ ਹੋ ਸਕਦਾ ਹੈ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹੋਰ ਮਾੜੀ ਕੰਡੀਸ਼ਨ ਹੋ ਜਾਵੇ ਜਿੱਦਾਂ ਕਿ ਅਸੀਂ ਬਿਮਾਰ ਹੋ ਜਾਈਏ ਘੱਟ ਪਾਣੀ ਪੀਣ ਨਾਲ ਜ਼ਰੂਰੀ ਹੈ ਕਿ ਤੁਹਾਡੀ ਸਕਿੰਨ ਪਤਲੀ ਹੋਏਗੀ ਹੈ ਤੁਹਾਡੇ 'ਚ ਫੈਟ ਘਟੇਗਾ ਜਿਹਨੂੰ ਕਿ ਵੋਟਰ ਫੈਟ ਕਿਹਾ ਜਾਂਦਾ ਹੈ ਮੰਨਿਆ ਕਿ ਉਹ ਵੋਟਰ ਫੈਟ ਘਟੇਗਾ ਬਟ ਉਹ ਵੀ ਕਿਤੇ ਨਾ ਕਿਤੇ ਨੁਕਸਾਨਬੰਦ ਕਰਦਾ ਹੈ ਕਿਉਂਕਿ ਜੇ ਤੁਹਾਡਾ ਸਰੀਰ ਹੀ ਸੈਵਨਟੀ ਏਟ ਪਰਸੈਂਟ ਪਾਣੀ ਨਾਲ ਬਣੇਗਾ ਅਤੇ ਤੁਹਾਨੂੰ ਉਹਦੀ ਲੋੜ ਹੁੰਦੀ ਹੁੰਦੀ ਹੈ ਅਤੇ ਪੂਰੇ ਦੌਰਾਨ ਵਿੱਚ ਤੁਹਾਨੂੰ ਘੱਟੋ ਘੱਟ ਤਿੰਨ ਤੋਂ ਚਾਰ ਲੀਟਰ ਪਾਣੀ ਪੀਣਾ ਹੀ ਚਾਹੀਦਾ ਜੋ ਕਿ ਇੱਕ ਐਸਟੀਮੇਟ ਜਾਂ ਅਪ੍ਰੋਕਸ ਹੁੰਦਾ ਸਾਰਿਆਂ ਵਾਸਤੇ ਜ਼ਰੂਰੀ ਹੁੰਦਾ ਬੁੱਢਾ ਹੋਏ ਬੱਚਾ ਹੋਏ ਜਵਾਨ ਹੋਏ ਜੋ ਮਰਜੀ ਹੋਏ ਬਾਕੀ ਦਿਨ ਦੇ ਦੌਰਾਨ ਤੁਹਾਨੂੰ ਪਾਣੀ ਪੀਂਦੇ ਰਹਿਣਾ ਚਾਹੀਦਾ ਪਾਣੀ ਦੇ ਵਿੱਚ ਇੱਕ ਨਮਕ ਪਾ ਗਿਆ ਖੰਡ ਪਾ ਕੇ ਜ਼ਰੂਰ ਪੀਣਾ ਚਾਹੀਦਾ ਹੈ ਜਿੱਦੇ ਦਾ ਤੁਹਾਡੀ ਸਰੀਰ ਦੇ ਵਿੱਚ ਜਿਹੜੇ ਅਸੈਂਸ਼ੀਅਲ ਅ ਅਮੀਨੋ ਐਸਿਟਸ ਨੇ ਉਹ ਵੀ ਮੌਜੂਦ ਰਹਿਣ ਬਾਕੀ ਪਾਣੀ ਇੱਕ ਬਹੁਤ ਹੀ ਨਸੈਸਰੀ ਚੀਜ਼ ਹੈ ਜਿਹਨੂੰ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਦਿਨ ਦੇ ਦੌਰਾਨ ਤੁਸੀਂ ਪਾਣੀ ਜਿੰਨਾ ਮਰਜੀ ਪੀ ਸਕਦੇ ਹੋ ਤੁਹਾਡੀ ਲਿਮਿਟ ਦੇ ਉੱਤੇ ਹੈ ਨਾਲੇ ਰਹੀ ਗੱਲ ਡੀਹਾਈਡਰੇਸ਼ਨ ਦੀ ਜੇ ਤੁਸੀਂ ਪਾਣੀ ਘੱਟ ਪੀਓਗੇ ਜਾਂ ਤੁਸੀਂ ਡੀਹਾਈਡਰੇਸ਼ਨ ਦੇ ਸ਼ਿਕਾਰ ਹੋਵੋਗੇ ਅਤੇ ਤੁਹਾਨੂੰ ਉੱਥੇ ਵੀ ਇਹੀ ਸੁਜੈਸਟ ਕੀਤਾ ਜਾਏਗਾ ਕਿ ਵੱਧ ਤੋਂ ਵੱਧ ਪਾਣੀ ਪੀਓ ਸੋ ਉਹ ਕੰਮ ਕਿਉਂ ਕਰਨਾ ਜਿਹਨਾਂ ਦਾ ਨੁਕਸਾਨ ਹੋਏ ਇਸ ਕਰਕੇ ਪਾਣੀ ਵੱਧ ਤੋਂ ਵੱਧ ਪੀਣ ਦੀ ਆਦਤ ਪਾਓ ਪਾਣੀ ਵੱਧ ਪੀਣ ਦੇ ਨੁਕਸਾਨ ਨਹੀਂ ਨੇ ਫਾਇਦਾ ਹੀ ਨੇ ਫਾਇਦੇ ਇੱਦਾਂ ਕਿ ਤੁਹਾਡੀ ਸਕਿੰਨ ਗਲੋ ਹੋਏਗੀ ਤੁਹਾਡੇ ਜਿਹੜੇ ਬੋਡੀ 'ਚੋਂ ਕੀਟਾਣੂ ਜਾਂ ਹਾਨੀਕਾਰਕ ਪਦਾਰਥ ਨੇ ਉਹ ਮੂਤਰ ਦੇ ਰਾਸਤੇ ਬਾਹਰ ਨਿਕਲ ਆਉਣਗੇ ਅਤੇ ਤੁਹਾਡਾ ਸਰੀਰ ਸਾਫ਼ ਸੁਥਰਾ ਰਹੇਗਾ ਤਾਂ ਹੀ ਲੋਕ ਫਾਸਟਿੰਗ 'ਚ ਪਾਣੀ ਜ਼ਿਆਦਾ ਤੋਂ ਪੀਂਦੇ ਨੇ ਇਸ ਚੀਜ਼ ਨੂੰ ਇੰਟਰਮਿਟ ਫਾਸਟਿੰਗ ਵੀ ਕਿਹਾ ਜਾਂਦਾ ਉਹਦੇ ਵਿੱਚ ਵੀ ਇਹੀ ਦੱਸਿਆ ਜਾਂਦਾ ਕਿ ਵੱਧ ਤੋਂ ਵੱਧ ਪਾਣੀ ਪੀਓ ਇੱਕ ਦਿਨ ਹਫ਼ਤੇ 'ਚ ਕੋਈ ਵੀ ਜਿਹਦੇ ਨਾਲ ਕਿ ਤੁਹਾਡਾ ਪੂਰਾ ਸਰੀਰ ਸਾਫ਼ ਹੋ ਜਾਏ ਜਿਹੜੇ ਵੀ ਟੋਕਸ਼ਜ ਨੇ ਉਹ ਸਾਰੇ ਤੁਹਾਡੇ ਸਰੀਰ 'ਚੋਂ ਨਿਕਲ ਜਾਣ ਇਸ ਕਰਕੇ ਪਾਣੀ ਤਾਂ ਰੋਜ਼ ਪੀਓ ਅਤੇ ਪਾਣੀ ਨੂੰ ਬਚਾਓ ਵੀ ਜਿਸ ਕਰਕੇ ਇਹ ਚੀਜ਼ ਖ਼ਤਮ ਕਦੀ ਨਾ ਹੋਵੇ